ਪੰਜਾਬ ਦੇ ਦੋ ਮੁੱਖ ਅਤੇ ਉੱਗੇ ਲੋਕ ਨਾਚਾਂ ਵਿੱਚੋਂ ਇੱਕ ਹੈ ਭੰਗੜਾ ਦੂਜਾ ਮੁੱਖ ਨਾਚ ਗਿੱਧਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦ ਕੀ ਗਿੱਧਾ ਮੁਟਿਆਰਾਂ ਦਾ ਹੈ ਭੰਗੜਾ ਤਕਰੀਬਨ ਹਰ ਇੱਕ ਖੁਸ਼ੀ ਦੇ ਮੌਕੇ ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਘਰ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੋਵੇ ਵਿਆਹ ਸ਼ਾਦੀਆਂ ਦਾ ਮਾਹੌਲ ਹੋਵੇ ਕਿਸੀ ਦੇ ਘਰ ਕੋਈ ਨਵੀਂ ਔਲਾਦ ਜੰਮੀ ਹੋਵੇ ਕਿਸੇ ਦੇ ਘਰ ਕੋਈ ਸੁੱਖਾਂ ਵਾਲਾ ਮਾਹੌਲ ਹੋਵੇ ਕਿਸੇ ਕ ਕਣਕ ਦੀ ਵਾਢੀ ਵਿਸਾਖੀ ਵਾਲੇ ਮੇਲੇ ਵਿਆਹ ਮੰਗਣੇ ਆਦਿ ਬਹੁਤ ਈ ਤਿਉਹਾਰ ਜੋ ਛੋਟੇ ਮੋਟੇ ਪੰਜਾਬੀ ਭਾਈਚਾਰੇ ਵਿੱਚ ਹੁੰਦੇ ਹਨ ਜਬ ਵਿੱਚ ਭੰਗੜੇ ਦੀ ਬਹੁਤ ਵੱਡੀ ਸ਼ਮੂਲੀਅਤ ਹੈ ਇਹ ਭੰਗੜੇ ਤੋਂ ਬਿਨ੍ਹਾਂ ਕੋਈ ਵੀ ਕ ਫੰਕਸ਼ਨ ਅਧੂਰਾ ਹੈ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ ਲੋਕ ਧਾਰਾ ਵਿਗਿਆਨੀ ਸੁਹਿੰਦਰ ਸਿੰਘ ਵਨਜਾਰਾ ਬੇਦੀ ਦੇ ਸ਼ਬਦਾਂ ਵਿੱਚ ਪਹਿਲ ਪਹਿਲ ਜਦੋਂ ਪੰਜਾਬੀਆਂ ਨੇ ਹਰੀ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ ਭੰਗੜੇ ਦੀ ਇੱਕ ਸਭ ਤੋਂ ਵੱਡੀ ਚੀਜ਼ ਹੈ ਸਾਰੇ ਹੀ ਜਿੰਨੇ ਵੀ ਭੰਗੜੇ ਦਾ ਗਰੁੱਪ ਹੁੰਦਾ ਸਾਰੇ ਇੱਕ ਈ ਸਟੈਪ ਤੇ ਅਲੱਗ ਅਲੱਗ ਵਸਤਰਾਂ ਦੇ ਪਗੜੀਆਂ ਬੰਨ ਕੇ ਜੋ ਨਾਚ ਭੰਗੜਾ ਪਾਉਂਦੇ ਹਨ ਦੇਖ ਕੇ ਸਾਰਿਆਂ ਦਾ ਹੀ ਦਿਲ ਬਹੁਤ ਖੁਸ਼ ਹੋ ਜਾਂਦਾ ਹੈ ਮੁੱਢ ਵਿੱਚ ਇਹ ਨਾਚ ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰਸਮਾਂ ਦਾ ਸਮੇਂ ਵੀ ਖੁੱਲੇ ਖੇਤਾਂ ਵਿੱਚ ਨੱਚਿਆਂ ਜਾਂਦਾ ਹੈ